ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਨੂੰ ਇਸ ਨੂੰ ਇਸ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਚਾਹੀਦੀ ਹੈ ਅੱਜ ਕੱਲ੍ਹ ਇੰਗਲਿਸ਼ ਨੂੰ ਜ਼ਿਆਦਾ ਮਾਨਤਾ ਦੇ ਰਹੇ ਹਨ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਪਰ ਬ ਪੰਜਾਬੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਧਰਤੀ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ ਇੱਥੇ ਪੰਜਾਬੀ ਬੋਲਣਾ ਇੱਕ ਸ਼ਾਨ ਦੀ ਗੱਲ ਹੁੰ ਸ਼ਾਨ ਦੀ ਗੱਲ ਹੈ ਜਿਸ ਤਰ੍ਹਾਂ ਕਿ ਬੱਚੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੰਗਲਿਸ਼ ਨੂੰ ਜ਼ਿਆਦਾ ਮਾਨਤਾ ਦੇ ਰਹੇ ਹਨ ਅਤੇ ਪੰਜਾਬੀ ਨੂੰ ਸੋਚਦੇ ਆ ਵੀ ਅਸੀਂ ਪਤਾ ਨਹੀਂ ਕੀ ਕੀ ਬੋਲਣਾ ਕੀ ਕੀ ਚੀਜ਼ ਹੈ ਇਹ ਪਰ

ਜ ਜਿਹੜੇ ਕਿ ਸਾਡੀ ਭਾਸ਼ਾ ਪੰਜਾਬੀ ਹੈ ਅਤੇ ਗੁਰੂਆਂ ਪੀਰਾਂ ਦੀ ਜਿਹੜੀ ਇਹ ਅਮਾਨਤ ਹੈ ਇਹਨੂੰ ਸਾਡੇ ਬੱਚੇ ਅੱਗੇ ਵੀ ਸਾਂਭ ਕੇ ਰੱਖਣ